ਹੈਲੋ ਜੋਨ ਕੀ ਹਾਲ ਹੈ ਮੈਂ ਠੀਕ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਨਵਾਂ ਮੋਬਾਈਲ ਨੰਬਰ ਖਰੀਦ ਲਿਆ ਹੈ ਜਿਸ ਕਰਕੇ ਮੈਨੂੰ ਥੋੜ੍ਹੀ ਦਿੱਕਤ ਦਾ ਸਾਹਮਣਾ ਕਰ ਰਿਹਾ ਕਰ ਰਿਹਾ ਹਾਂ ਕਿਉਂਕਿ ਡੀਜੀ ਲੱਕਰ ਵਿੱਚ ਜਿਹੜਾ ਮੇਰਾ ਮੋਬਾਇਲ ਨੰਬਰ ਹੈ ਜੋ ਅਟੈਚ ਹੈ ਵੋ ਪਹਿਲਾਂ ਵਾਲਾ ਹੈ ਜਿਸ ਕਰਕੇ ਮੈਨੂੰ ਆਪਣੇ ਡਾਕੂਮੈਂਟ ਵਿੱਚ ਕਰਨ ਫਿਚ ਬਹੁਤ ਸਾਰੀ ਦਿੱਕਤ ਆ ਰਹੀ ਹੈ ਜਿਸ ਕਰਕੇ ਮੇਰਾ ਜਿਹੜਾ ਕੰਮ ਆ ਜਾਂ ਮੇਰੇ ਹੋਰ ਦਸਤਾਵੇਜ਼ ਨੇ ਉਹ ਕਾਫੀ ਮੁਸ਼ਕਿਲ ਦੇ ਵਿੱਚ ਹਨ ਕਿਉਂਕਿ ਮੈਂ ਉਹਨਾਂ ਨੂੰ ਫਿਚ ਨਹੀਂ ਕਰ ਰਿਹਾ ਕਰ ਪਾ ਰਿਹਾ ਜਿਵੇਂ ਕਿ ਮੇਰਾ ਦਸਵੀਂ ਦਾ ਸਰਟਵਕੇਟ ਮੇਰਾ ਜਨਮ ਦਾ ਸਬੂਤ ਮੇਰੀ ਡਰਾਈਵਿੰਗ ਲਾਈਸੈਂਸ ਦੀ ਕਾਪੀ ਮੇਰੀ ਗੱਡੀ ਦੀ ਰਜਿਸਟਰੇਸ਼ਨ ਮੇਰਾ ਇਨਸ਼ੋਰੈਂਸ ਆ ਅਤੇ ਮੇਰਾ ਪੋਲਿਊਸ਼ਨ ਦਾ ਅਤੇ ਹੋਰ ਕਾਫੀ ਦਸਤਾਵੇਜ਼ ਤੁਸੀਂ ਇਸ ਕੰਮ ਬਾਰੇ ਮਾਹਿਰ ਹੋ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰਾ ਨਵਾਂ ਮੋਬਾਈਲ ਨੰਬਰ ਡੀਜੀ ਲੋਕਰ ਦੇ ਵਿੱਚ ਅਪਡੇਟ ਕਰ ਦਿਓ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਅਤੇ ਨਾਲ ਹੀ ਇਹ ਕਾਮਨਾ ਕਰਦਾ ਹਾਂ ਅਤੇ ਇਹ ਦੱਸਣਾ ਵੀ ਚਾਹੁੰਦਾ ਹਾਂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਅਤੇ ਅੱਗੇ ਵੀ ਤੁਸੀਂ ਮੇਰੇ ਲਈ ਆਈਂ ਚੰਗਾ ਕੰਮ ਕਰਦੇ ਰਹੋਗੇ ਮੈਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਜੇਕਰ ਆਪਾਂ ਇੱਕ ਮੀਟਿੰਗ ਕਰੀਏ ਤਾਂ ਇਸ ਬਾਰੇ ਬਹੁਤ ਚੰਗਾ ਹੋਵੇਗਾ ਮੈਂ ਅੱਜ ਸ਼ਾਮ ਸੱਤ ਵਜੇ ਦਾ ਟਾਈਮ ਸੋਚਿਆ ਹੈ ਅਗਰ ਤੁਸੀਂ ਮੇਰੇ ਨਾਲ ਮੀਟਿੰਗ ਕਰਨਾ ਚਾਹੁੰਦੇ ਹੋ ਅਗਰ ਜੇ ਤੁਸੀਂ ਕੰਫਰਟੇਬਲ ਹੋ ਤਾਂ ਤੁਸੀਂ ਮੈਨੂੰ ਇੱਕ ਸੁਨੇਹਾ ਭੇਜ ਦੇਣਾ ਅਤੇ ਜਗ੍ਹਾ ਲਿਖ ਕੇ ਸੈਂਡ ਕਰ ਦੇਣਾ ਤਾਂ ਮੈਂ ਉਸ ਜਗ੍ਹਾ ਉੱਪਰ ਆ ਜਾਵਾਂ